ਅਤੇ ਜਿਹੜੀ ਮੌਸਮ ਦੀ ਤਬਦੀਲੀ ਇਹ ਤਾਂ ਬਹੁਤ ਮਾਰ ਪਾਉਂਦੀ ਪੇਂਡੂ ਖੇਤਰਾਂ 'ਚ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਤਰ੍ਹਾਂ ਕਿਸਾਨਾਂ ਨੂੰ